ਮੈਂ ਆਪਣੇ ਘਰ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਪਕਵਾਨ ਬਣਾਉਂਦੀ ਹਾਂ ਜਿਵੇਂ ਕਿ ਰਾਜਮਾ ਚਾਵਲ ਕੜੀ ਚਾਵਲ ਮਾਹਾਂ ਦੀ ਦਾਲ ਮੂੰਗੀ ਮਸਰੀ ਅਤੇ ਹੋਰ ਦਾਲਾਂ ਬਣਦੀਆਂ ਹਨ ਸਾਗ ਅਤੇ ਮੱਕੀ ਦੀ ਰੋਟੀ ਵੀ ਬਣਦੀ ਹੈ ਅਤੇ ਹਰੀਆਂ ਸਬਜ਼ੀਆਂ ਵਿੱਚ ਘੀਆ ਕੱਦੂ ਬੈਂਗਣ ਤੋਰੀਆਂ ਸ਼ਿਮਲਾ ਮਿਰਚ ਅਤੇ ਆਲੂ ਮਟਰ ਬਣਦੇ ਹਨ ਅਤੇ ਜੇਕਰ ਕੋਈ ਪਰਿਵਾਰ ਵਿੱਚ ਬਿਮਾਰ ਹੋਵੇ ਤਾਂ ਉਹਦੇ ਲਈ ਬਹੁਤ ਹੀ ਹਲਕਾ ਖਾਣਾ ਬਣਾਇਆ ਜਾਂਦਾ ਹੈ ਜਿਵੇਂ ਕਿ ਦਲੀਆ ਖਿਚੜੀ ਜਾਂ ਚਾਵਲ ਬਣਾਏ ਜਾਂਦੇ ਹਨ